ਰਸੋਈ ਵਿੱਚ ਸਾਡੇ 'ਚ ਕਾਫ਼ੀ ਬਰਤਨ ਹੁੰਦੇ ਹਨ ਜਿਵੇਂ ਕਿ ਗਿਲਾਸ ਚਮਚ ਡੋਲੂ ਪਲੇਟ ਕੌਲੀ ਅਸੀਂ ਇਹਨਾਂ ਦੀ ਵਰਤਾ ਖਾਣਾ ਬਣਾਉਣ ਅਤੇ ਖਾਣ ਵਿੱਚ ਵਰਤਦੇ ਹਾਂ ਜਿਵੇਂ ਕਿ ਕੌਲੀ ਵਿੱਚ ਅਸੀਂ ਕੁਛ ਵੀ ਪਾ ਕੇ ਖਾ ਸਕਦੇ ਹਾਂ ਅਤੇ ਚਮਚਾ ਸਾਡੇ ਖਾਣਾ ਖਾਣ ਵਿੱਚ ਕੰਮ ਆਉਂਦਾ ਹੈ ਜਾਂ ਚਾਵਲ ਖਾਣ ਦੇ ਵਿੱਚ ਕੰਮ ਆਉਂਦਾ ਹੈ ਡੋਲੂ ਡੋਲੂ ਵਿੱਚ ਅਸੀਂ ਕੁਛ ਵੀ ਸਟੋਰ ਕਰ ਸਕਦੇ ਹਾਂ ਜਿਵੇਂ ਕਿ ਪਾਣੀ ਹੋ ਗਿਆ ਆਪਣਾ ਦੁੱਧ ਹੋ ਗਿਆ ਅਤੇ ਉਹਨਾਂ ਨੂੰ ਸਟੋਰ ਕਰਕੇ ਦੂਜੀ ਜਗ੍ਹਾ 'ਤੇ ਵੀ ਲੈ ਕੇ ਜਾ ਸਕਦੇ ਹਾਂ ਅਤੇ ਗਿਲਾਸ ਗਿਲਾਸ ਵਿੱਚ ਅਸੀਂ ਪਾਣੀ ਪਾ ਕੇ ਪੀ ਸਕਦੇ ਹਾਂ ਅਤੇ ਕਿਸੀ ਹੋਰ ਨੂੰ ਵੀ ਗਿਲਾਸ ਵਿੱਚ ਅਸੀਂ ਪਾਣੀ ਪਾ ਕੇ ਡਿਲੀਵਰ ਕਰ ਸਕਦੇ ਹਾਂ